ਵੈਸੇ ਤਾਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਸਾਡੀਆਂ ਮਨਪਸੰਦ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਅਸੀਂ ਕਿਸੇ ਖਾਸ ਕਿਤਾਬ ਨੂੰ ਪੜ੍ਹਦੇ ਹਾਂ ਭਾਵੇਂ ਉਹ ਨਵੇਂ ਸਮੇਂ ਦੀ ਆ ਭਾਵੇਂ ਕੋਈ ਕਲਾਸਿਕ ਰਚਨਾ ਪਰ ਪੜ੍ਹ ਕੇ ਜਿਹੜੀ ਸਾਡੇ ਮਨ ਨੂੰ ਚੰਗੀ ਲੱਗੇ ਉਹ ਸਾਡੀ ਮਨਪਸੰਦ ਕਿਤਾਬ ਕੋਈ ਵੀ ਕਿਤਾਬ ਹੋ ਸਕਦੀ ਆ ਪਰ ਕੁਛ ਕੁ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਖਾਸ ਹੁੰਦੀਆਂ ਨੇ ਤਾਂ ਉਹਨਾਂ ਪਿੱਛੇ ਖਾਸ ਦਾ ਕਾਰਨ ਇਹ ਹੁੰਦਾ ਕਿਉਂਕਿ ਇੱਕ ਤਾਂ ਉਹ ਕਈ ਵਾਰੀ ਹੁੰਦਾ ਕਿ ਉਹਨਾਂ ਦਾ ਰੀ ਐਡੀਸ਼ਨ ਜਿਹੜਾ ਉਹ ਨਵਾਂ ਐਡੀਸ਼ਨ ਨਹੀਂ ਛਪਿਆ ਹੁੰਦਾ ਤਾਂ ਪਹਿਲੇ ਐਡੀਸ਼ਨ ਦੀਆਂ ਕਿਤਾਬਾਂ ਜਿਹੜੀਆਂ ਉਹ ਸਾਨੂੰ ਕਿਤੋਂ ਜਿਹੜੀਆਂ ਸੌਖੇ ਤਰੀਕੇ ਨਾਲ ਨਹੀਂ ਮਿਲਦੀਆਂ ਇਸ ਤਰ੍ਹਾਂ ਹੀ ਇੱਕ ਕਿਤਾਬ ਆ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਿਹੜੀ ਕਿ ਮੇਰੇ ਲਈ ਜ਼ਰੂਰੀ ਸੀ ਔਰ ਮੈਂ ਉਹਨੂੰ ਬਹੁਤ ਜਿਹੜਾ ਵੱਖ ਵੱਖ ਪ੍ਰਕਾਸ਼ਿਤਾਂ ਕੋਲ ਪਤਾ ਕੀਤਾ ਜਾਂ ਵੱਖ ਵੱਖ ਜਿਹੜੀਆਂ ਬੁੱਕ ਮਾਰਕੀਟਾਂ ਨੇ ਕਿਤਾਬਾਂ ਦੀਆਂ ਦੁਕਾਨਾਂ ਨੇ ਉਹਨਾਂ ਤੋਂ ਲੱਭਿਆ ਜਿਹੜੀ ਕਿ ਮੈਨੂੰ ਸੌਖੇ ਤਰੀਕੇ ਨਾਲ ਕਿਤੋਂ ਨਹੀਂ ਮਿਲੀ ਤਾਂ ਉਹ ਕਿਤਾਬ ਸੀ ਡਾਕਟਰ ਹਰਕੀਤ ਸਿੰਘ ਦੀ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕਾਲਜੀ ਪੰਜਾਬੀ ਵਿਆਕਰਣ ਤਾਂ ਫਿਰ ਇੱਕ ਵਾਰ ਮੈਂ ਪਟਿਆਲੇ ਦੀ ਬੁੱਕ ਮਾਰਕੀਟ ਦੇ ਵਿੱਚ ਪਟਿਆਲੇ ਇੱਕ ਪੁਰਾਣੀਆਂ ਕਿਤਾਬਾਂ ਦੀ ਜਾਂ ਇੱਕ ਬਹੁਤ ਵੱਡੀ ਮਾਰਕੀਟ ਹੈ ਜਿਹਦੇ ਵਿੱਚ ਬਹੁਤ ਸਾਰਾ ਕਿਤਾਬਾਂ ਦਾ ਪੁਰਾਣਾ ਐਡੀਸ਼ਨ ਪੁਰਾਣੀਆਂ ਜਿਹੜੀਆਂ ਮੁੱਲਵਾਨ ਕਿਤਾਬਾਂ ਨੇ ਉਹ ਉਹਨਾਂ ਕੋਲ ਪਈਆਂ ਸੀ ਤਾਂ ਉੱਥੇ ਮੈਂ ਦੋ ਦਿਨ ਲਾ ਕੇ ਜਿਹੜਾ ਲਗਾਤਾਰ ਉਸ ਕਿਤਾਬ ਨੂੰ ਲੱਭਿਆ ਤਾਂ ਉਹ ਕਿਤਾਬ ਮੇਰੇ ਲਈ ਇੱਕ ਬਹੁਤ ਜਿਹੜੀ ਖਾਸ ਮੁੱਲਵਾਨ ਕਿਤਾਬ ਸੀ ਕਿਉਂਕਿ ਪੰਜਾਬੀ ਭਾਸ਼ਾ ਨਾਲ ਜੁੜੇ ਹੋਣ ਕਾਰਨ ਉਹ ਕਿਤਾਬ ਜ਼ਰੂਰੀ ਸੀ ਜਿਹਦੇ ਵਿੱਚ ਵਿਆਕਰਨ ਦੇ ਬਹੁਤ ਜਿਹੜੇ ਖਾਸ ਨੇਮ ਆ ਜਾਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਤਰ੍ਹਾਂ ਉਹ ਕਿਤਾਬ ਮੇਰੇ ਲਈ ਮੇਰੀ ਮਨਪਸੰਦ ਵੀ ਸੀ ਖਾਸ ਵੀ ਸੀ ਔਰ ਉਹਨੂੰ ਮੈਂ ਲੱਭਿਆ ਵੀ ਖਾਸ ਤਰੀਕੇ ਨਾਲ